ਸਾਡੇ ਖੇਤਰ ਦੀ ਮੁੱਖ ਕਲਾਕਾਰੀ ਦੇ ਰੂਪ ਵਿੱਚ ਦੇਖਿਆ ਜਾਏ ਤਾਂ ਸਾਡੇ ਖੇਤਰ ਵਿੱਚ ਹੋਣ ਵਾਲੀ ਖੇਤੀ ਹੈ ਖੇਤੀ ਤਾਂ ਪੈਟਨ ਜੋ ਹੈ ਉਹ ਬਹੁਤ ਵੱਖਰਾ ਹੈ ਸਾਡੇ ਖੇਤਰ ਵਿੱਚ ਹੋਣ ਵਾਲੀ ਖੇਤੀ ਕੀ ਹੈ ਜਿਹੜੇ ਆ ਕਈ ਵਾਰ ਬਹੁਤ ਵੱਡੇ ਵੱਡੇ ਅਤੇ ਕਈ ਵਾਰ ਬਹੁਤ ਛੋਟੇ ਛੋਟੇ ਵੀ ਹੁੰਦੇ ਹਨ ਅਤੇ ਪੰਜਾਬ ਤਾਂ ਇਲਾਕਾ ਜਿਹੜਾ ਮੇਨਲੀ ਗੁਰਦਾਸਪੁਰ ਦਾ ਇਲਾਕਾ ਆ ਇਹ ਸਮਤਲ ਇਲਾਕਾ ਹੈ ਅਤੇ ਇਸ ਵਿੱਚ ਖੇਤੀ ਕਰਨਾ ਬਹੁਤ ਆਸਾਨ ਹੁੰਦਾ ਜਿਸ ਕਰਕੇ ਇਹ ਕੀ ਕਰਦੇ ਹਨ ਕਿ ਵੱਟਾਂ ਬਣਾਉਂਦੇ ਹਨ ਅਤੇ ਉਸ ਵਿੱਚ ਇਸ ਰੂਪ ਨਾਲ ਵੱਟ ਬਣਾਉਦੇ ਹਨ ਕਿ ਇੱਕ ਵਾਰ ਪਾਣੀ ਜਿਹੜਾ ਹੈ ਇੱਕ ਨੂੰ ਦਿੱਤਾ ਜਾਏ ਤਾਂ ਉਹ ਵੱਖਰੇ ਵੱਖਰੇ ਖੇਤਾਂ ਤੱਕ ਪਹੁੰਚ ਸਕੇ ਜਿਸ ਦੇ ਨਾਲ ਸਮੇਂ ਵੀ ਬਚਦਾ ਹੈ ਅਤੇ ਇਸ ਵੱਧ ਤੋਂ ਵੱਧ ਫਸਲ ਨੂੰ ਜਿਹੜਾ ਆ ਪਾਣੀ ਵੀ ਮਿਲ ਜਾਂਦਾ ਦੂਜਾ ਸ਼ਿਲਪਕਾਰੀ ਜਿਹੜੀ ਆ ਉਹ ਚਾਦਰਾਂ ਦੀ ਵੀ ਗੈਰੀ ਕੀਤੀ ਜਾਂਦੀ ਹਨ ਜਿਹੜੇ ਸ਼ੋਲ ਵਗੈਰਾ ਏ ਜਿਹੜੇ ਜਲੰਧਰ ਲੁਧਿਆਣਾ ਵਿੱਚ ਬਣਾਏ ਜਾਂਦੇ ਹਨ ਉਹ ਅੱਜ ਕੱਲ੍ਹ ਇੱਥੇ ਵੀ ਬਣਾਉਣੇ ਸ਼ੁਰੂ ਹੋ ਗਏ ਹਨ ਜਿਹੜਾ ਆਮ ਬੰਦਾ ਹੈ ਉਹ ਵੱਖਰੀ ਵੱਖਰੀ ਸ਼ਿਲਪਕਾਰੀ ਕਰਦਾ ਹੈ ਅਤੇ ਉਹ ਵੱਖਰੇ ਵੱਖਰੇ ਉਰੇਕਦਾ ਹੈ ਚੀਜ਼ਾਂ ਕਿ ਜਿਹਨਾਂ ਨਾਲ ਉਹ ਸੁੰਦਰ ਹੋਰ ਹੋ ਸਕਣ ਅਤੇ ਉਹਨਾਂ ਦੀ ਵਿਕਰੀ 'ਤੇ ਵੀ ਅਸਰ ਪੈ ਸਕੇ ਹੋਰ ਇੱਥੇ ਬਣਨ ਵਾਲੀਆਂ ਚੀਜ਼ਾਂ ਜਿਹੜੀਆਂ ਹਨ ਵੱਖਰੇ ਵੱਖਰੇ ਕਲਾਕਾਰੀ ਹੈ ਜਿਵੇਂ ਕਿ ਸਪੋਰਟਸ ਦੇ ਸਮਾਨ ਹਨ ਸਪੋਰਟਸ ਖੇਲਾਂ ਜਿਵੇਂ ਕਿ ਵੋਲੀਬੋਲ ਕ੍ਰਿਕੇਟ ਕ੍ਰਿਕਟ ਬੈਟਸ ਕ੍ਰਿਕਟ ਬੈਟ ਬਹੁਤ ਬਣਦੇ ਹਨ ਕਿਉਂਕਿ ਇਹਨਾਂ ਦੀ ਡਿਮਾਂਡ ਜਿਹੜੀ ਹੈ ਉਹ ਸਾਡੇ ਖੇਤਰ ਵਿੱਚ ਬਹੁਤ ਹੈ ਅਤੇ ਲੋਕ ਜਿਹੜਾ ਇਹਨਾਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਇਹ ਖੇਤਰ ਵਿੱਚ ਮਿਲਣ ਵਾਲੇ ਵੱਖਰੀ ਚੀਜ਼ਾਂ ਜਿੱਦਾਂ ਬੂਟ ਆ ਲੈਦਰ ਦੇ ਅੱਜ ਕੱਲ੍ਹ ਆਪਣੇ ਆਪਣੇ ਨਵੇਂ ਨਵੇਂ ਛੋਟੇ ਛੋਟੇ ਬਿਜ਼ਨਸ ਲੋਕ ਸਟਾਰਟ ਕਰ ਰਹੇ ਹਨ ਜਿਸ ਵਿੱਚ ਉਹ ਚੀਜ਼ਾਂ ਖੁਦ ਬਣਾਉਂਦੇ ਹਨ ਅਤੇ ਉਹ ਇਹਨਾਂ ਦੀ ਵਿਕਰੋ ਵੱਧ ਤੋਂ ਵੱਧ ਹੁੰਦੀ ਹੈ ਕਿਉਂਕਿ ਲੋਕ ਚਾਹੁੰਦੇ ਹਨ ਕਿ ਉਹ ਜੋ ਸਾਹਮਣੇ ਬਣੀ ਨੇੜੇ ਬਣੀ ਚੀਜ਼ਾਂ ਹੀ ਉਹ ਖਰੀਦਣ ਅਤੇ ਉਹ ਇਸ 'ਤੇ ਬਹੁਤ ਭਰੋਸਾ ਕਰਦੇ ਹਨ